ਮੈਂ ਇੱਕ ਦਿਨ ਦੇ ਵਿੱਚ ਘੱਟ ਤੋਂ ਘੱਟ ਦੋ ਜਾਂ ਢਾਈ ਘੰਟੇ ਤੱਕ ਗਾਉਣ ਲਈ ਸਮਾਂ ਜਿਹੜਾ ਸਮਰਪਿਤ ਕਰਦਾਂ ਗਾਉਣ ਦਾ ਮੈਨੂੰ ਸ਼ੌਂਕ ਕਾਫੀ ਹੈ ਫਿਰ ਵੀ ਕੁਝ ਕੰਮਾਂ ਦੇ ਰੁਝੇਵੇਂ ਹੋਣ ਦਾ ਕਰਕੇ ਮੈਂ ਜਿੰਨਾਂ ਵੀ ਵੱਧ ਤੋਂ ਵੱਧ ਸਮਾਂ ਹੋ ਸਕੇ ਉਨਾਂ ਸਮਾਂ ਦਿੰਦਾ ਹਾਂ ਅਤੇ ਰਹੀ ਗੱਲ ਗੀਤ ਸਿੱਖਣ ਦੀ ਅਤੇ ਗੀਤ ਜਿਹੜਾ ਵਾ ਉਹ ਮੈਂ ਕਾਪੀ 'ਤੇ ਲਿਖ ਕੇ ਹਾਰਮੋਨੀ ਉਸ ਉਸ ਤੋਂ ਬਾਅਦ ਉਹਦੀਆਂ ਸਥਾਈਆਂ ਤਿਆਰ ਕਰਦਾ ਹਾਂ ਸਥਾਈਆਂ ਤਿਆਰ ਕਰਨ ਤੋਂ ਬਾਅਦ ਮੈਂ ਹਰਮੋਨੀਆ ਦੇ ਨਾਲ ਰਿਆਜ਼ ਕਰਕੇ ਉਹ ਜਿਹੜਾ ਗੀਤ ਆ ਉਹ ਸਿੱਖਦਾ ਹਾਂ ਅਤੇ ਉਸ ਤੋਂ ਇਲਾਵਾ ਮੈਂ ਕੁਝ ਸਾਡੇ ਜਿਹੜੇ ਪੁਰਾਣੇ ਪੰਜਾਬ ਦੇ ਕਲਾਕਾਰ ਆ ਯਮਲਾ ਜੱਟ ਗੁਰਦਾਸ ਮਾਨ ਉਹਨਾਂ ਦੀਆਂ ਉਹਨਾਂ ਤੋਂ ਪ੍ਰੇਰਨਾ ਲੈ ਕੇ ਕਿਸ ਤਰ੍ਹਾਂ ਢੱਡ ਸਰੰਗੀ ਹਰਮੋਨੀਆ ਜਾਂ ਅਲਗੋਜ਼ੇ ਜਿਹੜੇ ਉਹ ਵਜਾਏ ਜਾਂਦੇ ਆ ਉਹ ਕਿਸ ਤਰ੍ਹਾਂ ਵਜਾਏ ਜਾਂਦੇ ਆ ਉਹ ਮੈਂ ਉਹਨਾਂ ਤੋਂ ਪ੍ਰੇਰਣਾ ਲੈ ਕੇ ਉਹ ਸਿੱਖਦਾ ਹਾਂ ਅਤੇ ਫਿਰ ਵੀ ਮੈਂ ਜਿੰਨਾਂ ਵੀ ਵੱਧ ਤੋਂ ਵੱਧ ਸਮਾਂ ਹੋ ਸਕੇ ਮੈਂ ਦੇਨਾ ਹਾਂ ਹੋ ਸਕੇ ਤਾਂ ਮੈਨੂੰ ਸ਼ਾਮ ਨੂੰ ਵੀ ਮੈਂ ਦੋ ਜਾਂ ਢਾਈ ਘੰਟੇ ਜਿਹੜੇ ਆ ਉਹ ਆਪਣੇ ਰਿਆਜ਼ ਵਾਸਤੇ ਦੇਨਾ ਹਾਂ